ਰੇਡੀਓ 'ਤੇ ਮੈਨੂੰ ਜ਼ਿਆਦਾਤਰ ਮਿਊਜ਼ਿਕ ਸ਼ੋਅਜ਼ ਸੁਣਨੇ ਹੀ ਪਸੰਦ ਹਨ ਮੈਨੂੰ ਗਾਣੇ ਸੁਣਨਾ ਬਹੁਤ ਪਸੰਦ ਹੈ ਇਸ ਨਾਲ ਮੈਨੂੰ ਸ਼ਾਂਤੀ ਮਿਲਦੀ ਹੈ ਅਤੇ ਮੇਰਾ ਦਿਮਾਗ ਪੂਰਾ ਫਰੈਸ਼ ਹੋ ਜਾਂਦਾ ਹੈ ਅਤੇ ਜੇ ਮੈਂ ਰੇਡੀਓ ਨਹੀਂ ਸੁਣਦੀ ਤਾਂ ਫਿਰ ਟੀ ਵੀ ਵਿੱਚ ਮੈਂ ਜ਼ਿਆਦਾਤਰ ਵਾਹਿਗੁਰੂ ਜੀ ਬਾਰੇ ਸੁਣਦੀ ਹਾਂ ਬਾਣੀ ਸੁਣਦੀ ਹਾਂ ਬਾਣੀ ਪੜ੍ਹਦੀ ਹਾਂ ਇਸ ਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਮੇਰੇ ਪੂਰੇ ਦਿਨ ਦੀ ਥਕਾਨ ਦੂਰ ਹੋ ਜਾਂਦੀ ਹੈ ਇਸ ਤੋਂ ਬਾਅਦ ਮੈਨੂੰ ਖੇਡ ਅਤੇ ਵਿਗਿਆਨ ਨੂੰ ਵਧਾਉਣ ਵਾਲੇ ਪ੍ਰੋਗਰਾਮ ਬਹੁਤ ਪਸੰਦ ਹਨ ਇਸ ਮੇਰੀ ਜਾਣਕਾਰੀ ਨੂੰ ਵਧਾਉਂਦੇ ਹਨ ਅਤੇ ਮੈਨੂੰ ਨਵੀਂ ਸਿੱਖਿਆ ਦਿੰਦੇ ਹਨ